ਫੋਟੋ ਤੋਂ ਡਰਾਇੰਗ ਅਤੇ ਜੀਵਨ ਤੋਂ ਡਰਾਇੰਗ ਦੋਵਾਂ ਦੀਆਂ ਵੱਖ ਵੱਖ ਵਿਧੀਆਂ ਹਨ ਜੋ ਕਲਾ ਸਿੱਖਣ ਅਤੇ ਵਿਕਸਿਤ ਕਰਨ ਵਿੱਚ ਵਿਲੱਖਣ ਢੰਗ ਨਾਲ ਮਦਦ ਕਰਦੀਆਂ ਹਨ ਫੋਟੋ ਤੋਂ ਡਰਾਇੰਗ ਸਥਿਰਤਾ ਵਿਅਕਤੀ ਕਿਸੇ ਵੀ ਸਮਾਂ ਅਤੇ ਸਥਾਨ 'ਤੇ ਬੈਠ ਕੇ ਆਰਾਮ ਨਾਲ ਡਰਾਇੰਗ ਕਰ ਸਕਦਾ ਹੈ ਵਿਸ਼ਲੇਸ਼ਣ ਦੀ ਆਸਾਨੀ ਇੱਕੋ ਫੋਟੋ ਨੂੰ ਲੰਬਾ ਸਮਾਂ ਲਈ ਦੇਖ ਸਕਦੇ ਹੋ ਜਿਸ ਨਾਲ ਸ਼ਕਲ ਪ੍ਰੋਪ ਰੋਸ਼ਨ ਅਤੇ ਸੈਂਡੋ ਨੂੰ ਵਿਸ਼ਲੇਸ਼ਣ ਕਰਨਾ ਆਸਾਨ ਹੋ ਜਾਂਦਾ ਹੈ ਅਗਲਾ ਭਾਗ ਸ਼ੁਰੂਆਤੀ ਕਲਾਕਾਰ ਲਈ ਇਹ ਵਧੀਆ ਢੰਗ ਹੈ ਕਿਉਂਕਿ ਉਹਨਾਂ ਨੂੰ ਪਹਿਲਾਂ ਇੱਕ ਤਸਵੀਰ ਦਾ ਰੂਪ ਅਤੇ ਅਤੇ ਵਿਸ਼ਲੇਸ਼ਣ ਕਰਨਾ ਆਉਣਾ ਚਾਹੀਦਾ ਹੈ ਵਿਸ਼ੇਸ਼ ਤਰੀਕਾ ਸਮੁੰਦਰ ਪਹਾੜ ਜਾਂ ਰੇਅਰ ਪੋਸ ਵਾਲੀਆਂ ਫੋਟੋਆਂ ਦੀਆਂ ਵਰਤੋਂ ਕਰਕੇ ਜ਼ਿਆਦਾ ਲਾਭ ਪ੍ਰਾਪਤ ਕੀਤੀਆਂ ਜਾ ਸਕਦਾ ਹੈ ਚੁਣੌਤੀਆਂ ਮਿੱਤਰਾਂ ਦੀ ਕਮੀ ਤਸਵੀਰ ਸਤੀ ਕਲਾ ਨਾਲ ਸੰਪਰਕ ਨਹੀਂ ਬਣਾਉਂਦੀਆਂ ਜਿਸ ਕਰਕੇ ਕਲਾਕਾਰ ਨੂੰ ਹਸਤੀ ਵਿੱਚ ਤਿੰਨ ਪੱਖੀ ਡੈਮਥ ਦੀ ਘਾਟ ਮਹਿਸੂਸ ਹੋ ਸਕਦੀ ਹੈ ਰੰਗ ਅਤੇ ਸੌਡੇ ਦੀ ਹੱਦ ਫੋਟੋਆਂ 'ਚ ਹਮੇਸ਼ਾ ਰੰਗ ਅਤੇ ਚਮਕ ਦੀ ਥੋੜ੍ਹੀ ਬਿਹਤਰ ਜਾਂ ਘੱਟ ਉੱਤਮ ਗੁਣਵੱਤਾ ਹੁੰਦੀ ਹੈ ਜੋ ਕਿ ਅਸਲ ਜੀਵਨ ਵਿੱਚ ਨਹੀਂ ਹੁੰਦੀ